ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਮੈਂ ਤੁਹਾਡਾ ਨੰਬਰ ਦੇਖਿਆ ਸੀ ਗੂਗਲ ਤੋਂ ਐਟੀਟਿਊਡ ਸਲੂਨ ਤੋਂ ਗੱਲ ਕਰ ਰਹੇ ਹੋ ਹਾਂਜੀ ਇੱਕ ਮੇਰੀ ਫਰੈਂਡ ਵੀ ਤੁਹਾਡੇ ਪਿੱਛੇ ਜਿਹੇ ਰੈਡੀ ਹੋਈ ਸੀ ਆਪਣੀ ਇੰਗੇਜਮੈਂਟ ਵਾਸਤੇ ਅਤੇ ਮੈਂ ਪੁੱਛਣਾ ਸੀ ਹੇਅਰ ਸਟਾਈਲ ਵਗੈਰਾ ਮੈਂ ਕਰਵਾਉਣਾ ਸੀ ਥੋੜ੍ਹਾ ਮੈਨੂੰ ਦੱਸ ਦੋਂਗੇ ਉਹਦਾ ਮੇਰਾ ਨਾਮ ਕ੍ਰਿਤੀ ਹੈ ਹਾਂਜੀ ਹਾਂਜੀ ਮੇਰੀ ਇੰਗੇਜਮੈਂਟ ਹੈ

ਹਾਂਜੀ ਅੱਛਾ ਅੱਛਾ ਅੱਛਾ ਅਸੈਸਰੀਜ਼ ਵਗੈਰਾ ਮੈਂ ਆਪਣੀਆਂ ਲੈ ਕੇ ਜਾਵਾਂ ਕਿ ਤੁਸੀਂ ਪ੍ਰੋਵਾਈਡ ਕਰੋਂਗੇ ਅੱਛਾ ਹੁੰ ਹੁੰ ਹੁੰ ਹੁੰ ਅੱਛਾ ਠੀਕ ਹੈ ਅਤੇ ਤੁਸੀਂ ਪ੍ਰੋਡਕਟਸ ਵਗੈਰਾ ਕਿਹੜੇ ਯੂਜ ਕਰਦੇ ਹੋ ਲਾਈਕ ਮੈਂ ਹੈਡ ਵਾਸ਼ ਵੀ ਫਿਰ ਨਾਲ ਹੀ ਕਰਵਾਉਂਗੀ ਨਾ ਅੱਛਾ ਹਾਂਜੀ ਮੈਂ ਦੇਖ ਰਹੀ ਸੀ ਮੈਂ ਸਕੋਚਕੋਪ ਦੇ ਯੂਜ ਕਰਦੀ ਹਾਂ ਘਰ ਵੈਸੇ ਕਿਉਂਕਿ ਉਸ ਦਿਨ ਮੇਰੇ ਕੋਲ ਟਾਈਮ ਨਹੀਂ ਹੋਣਾ ਅਤੇ ਫਿਰ ਮੈਂ ਕਿਹਾ ਬਾਹਰੋਂ ਹੀ ਕਰਵਾ ਲਾਂ ਅਤੇ ਉਹ ਉਹਦੇ ਪ੍ਰੋਡਕਟਸ ਹੈਗੇ ਆ ਤੁਹਾਡੇ ਕੋਲ ਠੀਕ ਹੈ ਅਤੇ ਚਾਰਜਸ ਮੈਨੂੰ ਸਹੀ ਸਹੀ ਦੱਸੋ ਹੁਣ ਕੀ ਲਉਂਗੇ ਹਾਂਜੀ ਹਾਂਜੀ ਅੱਛਾ ਅਤੇ ਤੁਹਾਡੀ ਕੋਈ ਹੋਰ ਵੀ ਬਰਾਂਚ ਹੈਗੀ ਆ ਕਪੂਰਥਲਾ ਵਿੱਚ ਕਿ ਇੱਕੋ ਹੀ ਹੈ ਕਿ ਮੈਨੂੰ ਐਡਰੈਸ ਦੱਸ ਦਿਓ ਕਿ ਇਹ ਕਿੱਥੇ ਆ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਅਤੇ ਕੀ ਕਹਿੰਦੇ ਆ ਮੈਂ ਫਿਰ ਦਸ ਤਰੀਕ ਦੀ ਹੈ ਮੇਰੀ ਇੰਗੇਜਮੈਂਟ ਦਸ ਮਾਰਚ ਦੀ ਅਤੇ ਫਿਰ ਮੈਂ ਉਦੋਂ ਆਊਂਗੀ ਤੁਹਾਡੇ ਕੋਲ ਹਾਂਜੀ ਨਹੀਂ ਅਜੇ ਮੈਂ ਅਸੈਸਰੀ ਲਿੱਤੀ ਤਾਂ ਨਹੀਂ ਹੈ ਵੈਸੇ ਪਰ ਫਿਰ ਤੁਸੀਂ ਆਪਣੀ ਲਗਾ ਦਿਓ ਨਾ ਫਿਰ ਮੈਚ ਵਗੈਰਾ ਕਰ ਕੁਰ ਕੇ ਥੋੜ੍ਹਾ ਸੋਹਣਾ ਜਿਹਾ ਬਣਾ ਦਿਓ ਹਾਂਜੀ ਹਾਂਜੀ ਮੈਂ ਭੇਜ ਦਿੰਦੀ ਚਲੋ ਠੀਕ ਹੈ ਫਿਰ ਮੈਂ ਦੱਸ ਦੂੰਗੀ ਤੁਹਾਨੂੰ ਦੋ ਕੁ ਦਿਨ ਪਹਿਲਾਂ ਆਉਣ ਤੋਂ ਪਹਿਲਾਂ ਠੀਕ ਆ ਠੀਕ ਆ ਥੈਂਕ ਯੂ ਥੈਂਕ ਯੂ